ਭਾਰਤ ਰਾਜ ਦੇ ਵਿੱਚ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਇਸ ਤੋਂ ਇਲਾਵਾ ਸਾਊਥ ਇੰਡੀਆ ਦੇ ਵਿੱਚ ਤਮਿਲਨਾਡੂ ਵਗੈਰਾ ਸਟੇਟਾਂ ਕਾਫੀ ਹਨ ਜੋ ਕਿ ਘੁੰਮਣ ਦੇ ਲਾਇਕ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਕਿ ਗੋਲਡਨ ਟੈਂਪਲ ਹੈ ਉਹ ਕਾਫੀ ਫੇਮਸ ਹੈ ਅਤੇ ਸਿੱਖਾਂ ਦੀ ਸਭ ਤੋਂ ਵੱਡਾ ਧਾਰਮਿਕ ਅਸਥਾਨ ਹੈ ਉਹ ਕਾਫੀ ਵਧੀਆ ਸਥਾਨ ਬਣਿਆ ਹੋਇਆ ਹੈ ਇੱਥੇ ਦਿਲ ਨੂੰ ਉੱਥੇ ਕਾਫੀ ਖੁਸ਼ੀ ਮਿਲਦੀ ਹੈ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਹਿਮਾਚਲ ਪ੍ਰਦੇਸ਼ ਪਹਾੜੀ ਏਰੀਆ ਹੈ ਜਿੱਥੇ ਕਾਫੀ ਜ਼ਿਆਦਾ ਠੰਡ ਅਤੇ ਬਰਫਬਾਰੀ ਹੁੰਦੀ ਹੈ ਜੋ ਕਿ ਦੇਖਣ ਦੇ ਵਿੱਚ ਕਾਫੀ ਦਿਲ ਨੂੰ ਚੰਗਾ ਲੱਗਦਾ ਹੈ ਅਤੇ ਇਸ ਤੋਂ ਇਲਾਵਾ ਆਗਰਾ ਜਿੱਥੇ ਕਿ ਤਾਜ ਮਹਿਲ ਬਣਿਆ ਹੋਇਆ ਹੈ ਤਾਜ ਮਹਿਲ ਦੁਨੀਆਂ ਦੇ ਸੱਤ ਅਜੂਬਿਆਂ ਦੇ ਵਿੱਚੋਂ ਸੱਤਵਾਂ ਅਜੂਬਾ ਹੈ ਜੋ ਕਿ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿਲ ਨੂੰ ਭਾਵੁਕ ਕਰਦਾ ਹੈ ਉਹ ਸਭ ਨੂੰ ਦੇਖਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਮੁੰਬਈ ਜੋ ਕਿ ਇੱਕ ਬਹੁਤ ਹੀ ਵੱਡੀ ਸਿਟੀ ਹੈ ਉਹ ਵੀ ਇੱਕ ਅੱਧੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਦੇਖਣਾ ਚਾਹੀਦਾ ਹੈ ਅਤੇ ਪੰਜਾਬ ਦੇ ਵਿੱਚ ਚੰਡੀਗੜ੍ਹ ਬਹੁਤ ਹੀ ਵਧੀਆ ਵਸਿਆ ਹੋਇਆ ਸ਼ਹਿਰ ਹੈ ਉਸ ਨੂੰ ਵੀ ਇੱਕ ਵਾਰੀ ਜ਼ਰੂਰ ਦੇਖਣਾ ਚਾਹੀਦਾ ਹੈ